ਵਿਗਿਆਨ ਅਤੇ ਟੈਕਨੀਕ ਖੋਜਾਂ ਕਾਰਨ ਜ਼ਿੰਦਗੀ ਬਹੁਤ ਅਸਾਨ ਹੋ ਗਈ ਹੈ ਆਉਣ ਜਾਣ ਦੇ ਸਾਧਨਾਂ ਨੂੰ ਦੇਖ ਲਈਏ ਜਿੱਥੇ ਬਹੁਤ ਜ਼ਿਆਦਾ ਸਮੇਂ ਲੱਗਦਾ ਸੀ ਉੱਥੇ ਗੱਡੀਆਂ ਮੋਟਰ ਸਾਈਕਲਾਂ ਕਾਰਾਂ ਟ੍ਰੇਨਾਂ ਜਹਾਜ਼ਾਂ ਵਿੱਚ ਬਹੁਤ ਘੱਟ ਸਮੇਂ ਲਗਦਾ ਹੈ ਜਿਹਦੇ ਨਾਲ ਸਾਨੂੰ ਬਹੁਤ ਮਦਦ ਮਿਲੀ ਹੈ ਹੋਰ ਅਸੀਂ ਦੇਖ ਲਈਏ ਐਨਕਾਂ ਤੋਂ ਬਿਨਾਂ ਦੇਖਣਾ ਮੁਸ਼ਕਲ ਸੀ ਵਿਗਿਆਨ ਦੇ ਕਾਰਨ ਐਨਕਾਂ ਲਗਾ ਕੇ ਅਸੀਂ ਦੇਖਦੇ ਹਾਂ ਸਾਨੂੰ ਸਾਰਾ ਕੁਛ ਵਧੀਆ ਨਜ਼ਰ ਆਉਂਦਾ ਹੈ